ਧਰਮ ਪ੍ਰਤੀ ਅੰਧ ਵਿਸ਼ਵਾਸ ਬਹੁਤ ਪਾਏ ਜਾਂਦੇ ਹਨ ਹਰ ਧਰਮ ਦੇ ਵਿੱਚ ਅੰਧ ਵਿਸ਼ਵਾਸ ਸ਼ੁਰੂ ਤੋਂ ਹੀ ਸਦੀਆਂ ਤੋਂ ਹੀ ਚਲਦੇ ਆ ਰਹੇ ਹਨ ਸਾਡੇ ਦੇਸ਼ ਵਿੱਚ ਜਿੰਨੇ ਵੀ ਧਰਮ ਹਨ ਹਰ ਧਰਮ ਵਿੱਚ ਅੰਧ ਵਿਸ਼ਵਾਸ ਨਾਲ ਜੁੜੀਆਂ ਕੁਝ ਗੱਲਾਂ ਸਾਡੇ ਮੁਹੱਲਿਆਂ 'ਚ ਚਲਦੀਆਂ ਰਹਿੰਦੀਆਂ ਹਨ ਅਤੇ ਕੁਝ ਅਸੀਂ ਆਪਣੇ ਆਸ ਪਾਸ ਦੇ ਲੋਕਾਂ ਨਾਲ ਰੁ ਹਰ ਰੋਜ਼ ਦੀ ਤਰ੍ਹਾਂ ਵੀ ਕਰਦੇ ਹਾਂ ਅੰਧ ਵਿਸ਼ਵਾਸ ਇੱਕ ਅਜਿਹੀ ਜੜ੍ਹ ਹੈ ਜੋ ਹੁਣ ਤੱਕ ਨਹੀਂ ਪੱਟੀ ਗਈ ਇਸ ਨੂੰ ਨਜਿੱਠਣ ਲਈ ਸਾਨੂੰ ਆਪਣੇ ਹਰ ਵਿਅਕਤੀ ਨੂੰ ਆਪਣੇ ਧਰਮ ਬਾਰੇ ਗਿਅ ਇੰਨਾ ਕੁ ਗਿਆਨ ਪ੍ਰਾਪਤ ਹੋਣਾ ਚਾਹੀਦਾ ਤਾਂ ਕਿ ਉਹ ਅੰਧ ਵਿਸ਼ਵਾਸ ਤੋਂ ਉੱਪਰ ਉੱਠ ਸਕੇ ਅਤੇ ਹੋਰ ਆਪਣੇ ਆਸ ਪਾਸ ਦੇ ਲੋਕਾਂ ਨੂੰ ਵੀ ਧਰਮ ਪ੍ਰਤੀ ਜਾਗਰੂਕ ਕਰੇ ਤਾਂ ਕਿ ਅਸੀਂ ਆਪਣਾ ਜਿਹੜਾ ਧਰਮ ਪ੍ਰਤੀ ਸ਼ਰਧਾ ਹੈ ਉਸ ਨੂੰ ਸਹੀ ਢੰਗ ਨਾਲ ਨਿਭਾ ਸਕੀਏ ਅੰਧ ਵਿਸ਼ਵਾਸ ਇੱਕ ਬਿਮਾਰੀ ਦੀ ਤਰ੍ਹਾਂ ਹਰ ਮਨੁੱਖ ਨੂੰ ਲੱਗਿਆ ਹੋਇਆ ਹੈ ਇਸ ਵਿੱਚੋਂ ਨ ਨਿਕ ਅੰਧ ਵਿਸ਼ਵਾਸ ਵਿੱਚੋਂ ਨਿਕਲਣਾ ਮਨੁੱਖ ਨੂੰ ਦਿਨ ਪ੍ਰਤੀ ਦਿਨ ਔਖਾ ਹੋ ਜਾਂਦਾ ਹੈ ਹੁ ਸਮੇਂ ਦੇ ਨਾਲ ਬਹੁਤ ਸਾਰੇ ਅੰਧ ਵਿਸ਼ਵਾਸ ਨੇ ਜਿਹੜੇ ਘੱਟ ਗਏ ਨੇ ਪਰ ਇਨ ਇੰਨਾ ਵੀ ਅਜੇ ਅੰਧ ਵਿਸ਼ਵਾਸ ਦੇ ਵਿੱਚ ਦੁਨੀਆ ਹੈ ਕਿ ਅਸੀਂ ਪੂਰੀ ਤਰ੍ਹਾਂ ਇਸ ਅੰਧ ਵਿਸ਼ਵਾਸ ਤੋਂ ਬਾਹਰ ਨਹੀ ਆ ਸਕੇ ਇਸ ਨੂੰ ਨਜਿੱਠਣ ਲਈ ਸਾਨੂੰ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਧੰਨਵਾਦ